ਸਰੋਤਾਂ ਦੀ ਘਾਟ ਕਾਰਨ ਖੇਤਰ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ ਪਿਆ ਹੈ ਅਸੀਂ ਜਾਣਦੇ ਹਾਂ ਕਿ ਸਹੀ ਤਕਨੀਕਾਂ ਜਾਂ ਉਹ ਸਰੋਤ ਉਪਲਬਧਨ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਨੂੰ ਉਹਨਾਂ ਸਰੋਤਾਂ ਦੀ ਉਪਲਬਧੀ ਦੇ ਲਈ ਹੀ ਆਪਣੇ ਪਿੰਡ ਜਾਂ ਖੇਤਰ ਤੋਂ ਬਾਹਰ ਜਾਣਾ ਪੈਂਦਾ ਹੈ ਅਤੇ ਸ਼ਹਿਰ ਜਾ ਕੇ ਉਸ ਚੀਜ਼ ਦੀ ਉਪਲਬਧੀ ਕਰਵਾਉਣੀ ਪੈਂਦੀ ਆ ਅਤੇ ਇਹਨਾਂ ਚੀਜ਼ਾਂ ਵਿੱਚ ਲੋਕਾਂ ਦਾ ਆਉਣ ਜਾਣ ਦੇ ਵਿੱਚ ਅਤੇ ਉੱਥੋਂ ਤੱਕ ਪਹੁੰਚਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਆ ਅਤੇ ਉਹਨਾਂ ਦੀ ਜਿਹੜੀ ਸਿਹਤ ਆ ਉਹਨਾਂ 'ਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਆ ਅਤੇ ਬਟ ਅੱਜ ਦੇ ਸਮੇਂ ਦੇ ਵਿੱਚ ਇਹ ਲੋੜ ਪੂਰੀ ਹੁੰਦੀ ਜਾ ਰਹੀ ਆ ਅਤੇ ਜਿਹੜੇ ਨੇੜੇ ਦੇ ਟੀਕਾਕਰਨ ਨੇ ਟੀਕੇ ਕੇਂਦਰ ਦੇ ਉਹ ਸਾਡੇ ਖੇਤਰ ਦੇ ਵਿੱਚ ਖੁੱਲ੍ਹਦੇ ਜਾ ਰਹੇ ਨੇ ਜਿਵੇਂ ਜਿਵੇਂ ਅੱਜ ਦਾ ਮਨੁੱਖ ਤਰੱਕੀ ਕਰ ਰਿਹਾ ਆ ਉਵੇਂ ਉਵੇਂ ਉਹਨਾਂ ਦੇ ਪਛੜੇ ਹੋਏ ਖੇਤਰ ਵੀ ਤਰੱਕੀ ਕਰ ਰਹੇ ਨੇ ਅਤੇ ਸਾਡੇ ਜਿਹੜੇ ਖੇਤਰ ਆ ਉਹਦੇ ਵਿੱਚ ਟੀਕਾ ਅਤੇ ਟੀਕਾਕਰਨ ਕੇਂਦਰ ਵੀ ਹੁਣ ਅੱਜ ਦੇ ਸਮੇਂ ਦੇ ਵਿੱਚ ਉਪਲਬਧ ਹੋ ਰਹੇ ਨੇ